ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਮੈਂ ਵੀ ਵਧੀਆ ਜੀ ਕਰੋ ਜੀ ਅੱਛਾ ਜੀ ਹਾਂਜੀ ਹਾਂਜੀ

ਅ ਹਾਂਜੀ ਹਾਂਜੀ ਫਰੀ ਹੈ ਜੀ ਫਰੀ ਹੈ ਤੁਸੀਂ ਦੱਸੋ ਤੁਸੀਂ ਆਉਣਾ ਕਦੋਂ ਹੈ ਜੀ ਕੋਈ ਨਹੀਂ ਜੀ ਆ ਜਾਵਾਂਗੇ ਫਰੀ ਤੁਸੀਂ ਮੈਨੂੰ ਜਗ੍ਹਾਵਾਂ ਆਪਣੀ ਪਸੰਦ ਦੀਆਂ ਦੱਸ ਦਿਓ ਕੁਛ ਮੈਂ ਤੁਹਾਨੂੰ ਆਪਣੀ ਪਸੰਦ ਦੀਆਂ ਘੁੰਮਾ ਦੂੰਗਾ ਅੱਛਾ ਜੀ ਹਾਂਜੀ ਹਾਂਜੀ ਜਰੂਰ ਹੈ ਜੀ

ਇਹਦੇ ਬਾਰੇ ਜੀ ਤੁਹਾਨੂੰ ਪਹਿਲਾਂ ਅਸੀਂ ਲੈ ਕੇ ਜਾਵਾਂਗੇ ਦੁਖਨਿਵਾਰਨ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਆਲਮਗੀਰ ਸਾਹਿਬ ਜੀ ਆਲਮਗੀਰ ਸਾਹਿਬ ਚੱਲਾਂਗੇ ਜੀ ਅ ਰਾੜਾ ਸਾਹਿਬ ਅ ਦੁਖਨਿਵਾਰਨ ਸਾਹਿਬ ਹਾਂਜੀ ਹਾਂਜੀ ਹਾਂਜੀ ਹਾਂਜੀ ਹੈਗਾ ਜੀ ਇਹ ਉੱਥੇ ਵੀ ਚੱਲਾਂਗੇ ਤੁਸੀਂ ਕਿੰਨੇ ਟਾਈਮ ਲਈ ਆਉਣਾ ਹੈ ਜੀ ਚਲੋ ਠੀਕ ਆ ਜੀ ਰਾਤ ਨੂੰ ਤੁਹਾਨੂੰ ਸਾਊਥ ਸਿਟੀ ਵੀ ਲੈ ਕੇ ਚੱਲਾਂਗੇ ਜੀ ਉੱਥੇ ਵੀ ਬੜਾ ਵਧੀਆ ਮਾਹੌਲ ਹੁੰਦਾ ਹਾਂਜੀ ਹਾਂਜੀ ਘੁੰਮਣ ਫਿਰਨ ਨੂੰ ਰਹਿਣ ਸਹਿਣ ਦਾ ਰਹਿਣ ਸਹਿਣ ਦਾ ਤੁਸੀਂ ਮੇਰੇ ਕੋਲ ਵੀ ਰਹਿ ਲਿਓ ਜੀ ਕੋਈ ਚੱਕਰ ਨਹੀਂ ਹੈਗਾ ਵਧੀਆ ਪਛਾਣ ਦਾ ਤੁਹਾਨੂੰ ਪਾਰਕ ਪਲਾਜਾ 'ਚ ਕਰਵਾ ਦਿੰਦੇ ਹਾਂ ਜੀ ਉੱਥੇ ਹੈਗੇ ਆ ਜੀ ਹਾਂ ਹਾਂਜੀ ਹਾਂਜੀ ਹਾਂਜੀ ਅਤੇ ਬਸ ਤੁਸੀਂ ਮੈਨੂੰ ਇੱਕ ਵਾਰ ਕਨਫਰਮ ਕਰਦੇ ਦਿਓ ਤੁਸੀਂ ਆਉਣਾ ਕਦੋਂ ਆ

ਖਾਣ ਪੀਣ ਦਾ ਤੁਸੀਂ ਵੈਜ ਹੋ ਕਿ ਨੌਨ ਵੈਜ ਹੋ ਜੀ ਦੋਵੇਂ ਹੀ ਹੈ ਅਤੇ ਤੁਹਾਨੂੰ ਲੈ ਕੇ ਚੱਲਾਂਗੇ ਜੀ ਬਾਬਾ ਚਿਕਨ ਦੇ ਜੇ ਤੁਸੀਂ ਪ੍ਰੈਫਰ ਕਰਦੇ ਹੋ ਇਹ ਜਿਹੜਾ ਸਭ ਤੋਂ ਪੁਰਾਣਾ ਜੀ ਉਹ ਤਾਂ ਆਪਣਾ ਇੱਧਰ ਪੈਂਦਾ ਜੀ ਅ ਪ੍ਰਤਾਪ ਚੌਂਕ ਵਾਲੇ ਪਾਸੇ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਵੈਜ 'ਚ ਤੁਸੀਂ ਵੀਰ ਜੀ ਮ ਮਲਾਈ ਚਾਪ ਵਾਲੇ ਦੇ ਜਾਇਓ ਜੀ ਹਾਂ ਹਾਂਜੀ ਹਾਂਜੀ ਹਾਂਜੀ ਪਕੌੜੇ ਉਹ ਆਪਾਂ ਫਿਰ ਸ਼ਾਮ ਦਾ ਰੱਖ ਲਾਂਗੇ ਜੀ ਬਹੁਤ ਸੁਆਦ ਦਿੰਦਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਬਸ ਮੈਨੂੰ ਇੱਕ ਵਾਰ ਦੱਸ ਦਿਓ ਤੁਸੀਂ ਆਉਣਾ ਕਿਵੇਂ ਹੈ ਅਤੇ ਆਉਣਾ ਕਿਵੇਂ ਹੈ ਤੁਸੀਂ ਬਾਏ ਬੱਸ ਕਿ ਟ੍ਰੇਨ ਠੀਕ ਹੈ ਜੀ ਜ਼ਰੂਰ ਆ ਜਾਇਓ ਜੀ

ਠੀਕ ਹੈ ਠੀਕ ਹੈ ਜੀ ਓਕੇ

ਓਕੇ ਜੀ ਓਕੇ ਜੀ ਓਕੇ ਸ਼ੁਕਰੀਆ ਜੀ ਬਾਏ